ਮੈਨੂੰ ਚਾਹ ਬਹੁਤ ਪਸੰਦ ਹੈ ਚਾਹ ਬਣਾਉਣ ਲਈ ਮੈਂ ਫਰਾਈ ਪੈਨ ਵਿੱਚ ਪਾਣੀ ਲੈਂਦੀ ਹਾਂ ਉਸ ਤੋਂ ਬਾਅਦ ਜਦੋਂ ਪਾਣੀ ਉਬਲਣ ਲੱਗ ਜਾਂਦਾ ਹੈ ਤਾਂ ਉਸ ਵਿੱਚ ਚਾਹ ਪੱਤੀ ਅਤੇ ਮਿੱਠਾ ਪਾ ਦਿੰਦੀ ਹਾਂ ਉਸ ਤੋਂ ਬਾਅਦ ਨਾਲ ਹੀ ਲੌਂਗ ਇਲਾਇਚੀਆਂ ਪਾ ਦਿੰਦੀ ਹਾਂ ਇਸ ਤੋਂ ਬਾਅਦ ਉਸ ਨੂੰ ਚਾਰ ਪੰਜ ਮਿੰਟ ਪੱਕਣ ਲਈ ਰੱਖਦੀ ਹਾਂ ਅਤੇ ਉਸ ਤੋਂ ਬਾਅਦ ਚਾਹ ਦੇ ਹਿਸਾਬ ਨਾਲ ਦੁੱਧ ਪਾ ਦਿੰਦੀ ਹਾਂ ਅਤੇ ਉਬਾਲੀ ਦਿਵਾ ਕੇ ਚਾਹ ਲਾਹ ਲੈਂਦੀ ਹਾਂ